ਧਰਤੀ ਦੇ ਉਪਜ ਕਿਵੇਂ ਹੋਈ ਤਾਰੇ ਕਿਵੇਂ ਹੁੰਦੇ ਆ ਤੇ ਆਪਣੇ ਸੋਲਰ ਸਿਸਟਮ ਵਿੱਚ ਕਿੰਨੇ ਪਲੈਨਟਸ ਹੈ ਕੀ ਕਿਵੇਂ ਸਾਰਾ ਜੀਵਨ ਆਪਣਾ ਬਣਿਆ ਇਹ ਸਾਰੇ ਚੀਜ਼ਾਂ ਆਪਾਂ ਕਿੱਥੋਂ ਸਿੱਖ ਸਕਦੇ ਆਂ ਸਾਇੰਸ ਤੋਂ ਆਪਾਂ ਨੂੰ ਸਾਇੰਸ ਦੇ ਸਬਜੈਕਟਸ ਆ ਜਿਹੜੇ ਉਹ ਆਪਾਂ ਨੂੰ ਸ਼ੁਰੂ ਤੋਂ ਲਾ ਦਿੰਦੇ ਆ ਕਲਾਸ ਫਸਟ ਤੋਂ ਹੀ ਲਾ ਦਿੰਦੇ ਆ ਉਥੋਂ ਆਪਾਂ ਨੂੰ ਸਾਇੰਸ ਬਾਰੇ ਨੌਲੇਜ ਮਿਲਣੀ ਸ਼ੁਰੂ ਹੁੰਦੀ ਹੈ ਆਪਣਾ ਬੇਸ ਵੱਧਦਾ ਹੌਲੀ ਹੌਲੀ ਜਿਵੇਂ ਜਿਵੇਂ ਵੱਡੇ ਹੁੰਦੇ ਆ ਆਪਾਂ ਸਾਇੰਸ ਨੂੰ ਪੜਦੇ ਆ ਉਹਦੇ ਬਾਰੇ ਆਪਾਂ ਨੋਲਿਜ ਲੈਨੇ ਆ ਤੇ ਆਪਾਂ ਸੋਲਰ ਸਿਸਟਮ ਦਾ ਮਤਲਬ ਜੇ ਆਪਾਂ ਅਧਿਐਨ ਕਰਨਾ ਹੋਵੇ ਤਾਂ ਆਪਾਂ ਸਾਇੰਸ ਦੀ ਹੈਲਪ ਨਾਲ ਹੀ ਕਰ ਸਕਦੇ ਆਂ ਕਿਉਂਕਿ ਜਿਹੜੇ ਸਾਇੰਟਿਸਟ ਹੈ ਉਹ ਸਾਇੰਸ ਦੀ ਹੈਲਪ ਨਾਲ ਬਹੁਤ ਸਾਰੇ ਐਕਸਪੈਰੀਮੈਂਟ ਕਰਦੇ ਆ ਫਿਰ ਉਹਨਾਂ ਨੂੰ ਬੁਕਸ ਵਿੱਚ ਪਬਲਿਸ਼ ਕਰਦੇ ਆ ਜਿਦੇ ਨਾਲ ਆਪਾਂ ਉਸ ਤੋਂ ਬਹੁਤ ਕੁਝ ਸਿੱਖ ਸਕਦੇ ਆਂ ਜਿਵੇਂ ਆਪਣੇ ਬਹੁਤ ਸਾਰੇ ਮਿਥ ਸੀਗੇ ਆਪਣੇ ਧਰਤੀ ਨਾਲ ਰਿਲੇਟਡ ਤਾਰਿਆਂ ਨਾਲ ਰਿਲੇਟਡ ਬਹੁਤ ਸਾਰੇ ਮਤਲਬ ਅੰਧ ਵਿਸ਼ਵਾਸ ਸੀ ਜਿਹੜੇ ਕਿ ਸਾਇੰਸ ਨੂੰ ਪੜ੍ਹ ਕੇ ਆਪਾਂ ਦੂਰ ਕਰ ਸਕਦੇ ਆਂ ਫਾਰ ਇਗਜਾਮਪਲ ਜਿਵੇਂ ਮੇਰੀ ਦਾਦੀ ਮਾਂ ਮੈਨੂੰ ਛੋਟੇ ਹੁੰਦੇ ਸਟੋਰੀ ਸੁਣਾਉਂਦੇ ਹੁੰਦੇ ਸੀ ਵੀ ਜਦੋਂ ਬਹੁਤ ਪਹਿਲਾਂ ਬਹੁਤ ਸਮੇਂ ਦੀ ਗੱਲ ਹੈ ਵੀ ਜਿਵੇਂ ਜਿਹੜੇ ਤਾਰੇ ਹੁੰਦੇ ਸੀ ਉਹ ਧਰਤੀ ਉੱਤੇ ਹੁੰਦੇ ਸੀ ਪਹਿਲਾਂ ਫਿਰ ਇੱਕ ਦਿਨ ਕਿਸੇ ਨੇ ਕੁੜੀ ਨੇ ਤਾਰਾ ਤੋੜ ਲਿਆ ਇੱਕ ਤੇ ਉਹ ਫਿਰ ਅਸਮਾਨ 'ਚ ਚਲੇ ਗਏ ਵੀ ਛੋਟੇ ਹੁੰਦੇ ਤਾਂ ਆਪਾਂ ਨੂੰ ਨਹੀਂ ਪਤਾ ਹੁੰਦਾ ਸੀ ਆਪਾਂ ਨੂੰ ਇਹ ਲੱਗਦਾ ਸੀ ਵੀ ਸਟੋਰੀ ਸੱਚ ਪਰ ਜਿਵੇਂ ਜਿਵੇਂ ਵੱਡੇ ਹੋਏ ਆਪਾਂ ਸਾਇੰਸ ਪੜੀ ਆਪਾਂ ਨੂੰ ਪਤਾ ਲੱਗਿਆ ਵੀ ਜਿਵੇਂ ਵੀ ਆਹ ਜਿਹੜੇ ਤਾਰੇ ਆ ਇਹ ਤਾਂ ਇੱਕ ਪੱਥਰ ਹੁੰਦੇ ਆ ਆਪਣੀ ਧਰਤੀ ਤੋਂ ਬਹੁਤ ਦੂਰ ਹੁੰਦੇ ਆ ਇਸ ਕਰਕੇ ਆਪਾਂ ਨੂੰ ਰਾਤ 'ਚ ਚਮਕਦੇ ਹੋਏ ਦਿਖਦੇ ਹੁੰਦੇ ਆ ਇਹ ਮਿਥ ਵੀ ਕਲੀਅਰ ਹੋਇਆ ਤੇ ਜਿਵੇਂ ਅੱਜ ਕੱਲ ਲੋਕ ਕਹਿੰਦੇ ਆ ਵੀ ਜੇ ਕੋਈ ਮਰ ਜਾਂਦਾ ਬੰਦਾ ਤਾਂ ਉਹ ਤਾਰਾ ਬਣ ਜਾਂਦਾ ਤਾਂ ਇਹ ਵੀ ਇੱਕ ਅੰਧ ਵਿਸ਼ਵਾਸ ਹੈ ਜਿਹੜਾ ਕਿ ਆਪਾਂ ਸਾਇੰਸ ਨੂੰ ਪੜ੍ਹ ਕੇ ਦੂਰ ਕੀਤਾ ਇਸ ਤੋਂ ਇਲਾਵਾ ਕੁਝ ਕ ਲੋਕ ਕਹਿੰਦੇ ਵੀ ਧਰਤੀ ਹ ਜਿਹੜੀ ਬਲਦ ਦੇ ਸਿੰਘਾਂ ਤੇ ਚੱਕੀ ਹੋਈ ਹੈ ਜਾਂ ਆਪਣੀ ਧਰਤੀ ਚੌਰਸ ਹੈ ਗੋਲ ਨਹੀਂ ਗੀ ਇਹ ਸਾਰੀਆਂ ਚੀਜ਼ਾਂ ਸਾਇੰਸ ਪੜ੍ਹ ਕੇ ਆਪਾਂ ਦੂਰ ਕਰ ਸਕਦੇ ਆਂ ਇਸ ਤੋਂ ਇਲਾਵਾ ਕੀ ਇਹ ਸਾਇੰਸ ਇਹਨਾਂ ਜਦੋਂ ਆਪਾਂ ਤਾਰਿਆਂ ਤੇ ਬ੍ਰਮੰਡ ਦਾ ਅਧਿਐਨ ਕੀਤਾ ਇਸ ਤੋਂ ਬਾਅਦ ਆਪਾਂ ਨੂੰ ਪਤਾ ਲੱਗਿਆ ਵੀ ਆਪਣੀ ਧਰਤੀ ਤੋਂ ਇਲਾਵਾ ਹੋਰ ਜਿਹੜੇ ਪਲੈਡਿਟਸ ਆ ਉਸ ਤੇ ਵੀ ਆਪਣੀ ਲਾਈਫ ਪੋਸੀਬਲ ਹੋ ਸਕਦੀ ਹ ਜਿਵੇਂ ਚੰਦਯਾਨ ਪ੍ਰੋਜੈਕਟ ਚਲਾਇਆ ਸੀ ਮੂਨ ਤੇ ਗਏ ਉੱਥੇ ਪਾਣੀ ਦੀ ਖੋਜ ਕੀਤੀ ਇਸ ਤੋਂ ਇਲਾਵਾ ਮਾਰਚ ਤੱਕ ਪਹੁੰਚਿਆ ਆਪਣੇ ਸਾਇੰਟਿਸਟ ਕਿਹਦੀ ਹੈਲਪ ਨਾਲ ਸਾਈਜ਼ ਦੀ ਹੈਲਪ ਨਾਲ ਵੀ ਆਪਾਂ ਜੇ ਆਪਣੀ ਧਰਤੀ ਨੂੰ ਕੋਈ ਖਤਰਾ ਵੀ ਹੁੰਦਾ ਤਾਂ ਆਪਾਂ ਕੀ ਹੈ ਸਾਇੰਸ ਦੇ ਹੈਲਪ ਨਾਲ ਇਹਨਾਂ ਦੇ ਅਧਿਐਨ ਨਾਲ ਆਪਾਂ ਇਹ ਦੇਖ ਸਕਦੇ ਆ ਕਿ ਆਪਣਾ ਜੀਵਨ ਹੈ ਕਿਸੇ ਹੋਰ ਪਲੈਨਟ ਤੇ ਵੀ ਜਾ ਸਕਦਾ